ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਜੋ ਕਿ ਡੀਜੀਲਾਕਰ ਵਿੱਚ ਅੱਛਾ ਐਕਸਪਰਟ ਹੈ ਮੈਂ ਉਸ ਨੂੰ ਦੱਸਿਆ ਕਿ ਮੇਰੇ ਪਰਿਵਾਰ ਦੀ ਕੁਝ ਪੁਰਾਣੀ ਫੋਟੋ ਐਲਬਮ ਮਿਲੀ ਜਿਹਨਾਂ ਵਿੱਚ ਕਾਫੀ ਤਸਵੀਰਾਂ ਹਨ ਅਤੇ ਮੈਨੂੰ ਉਹ ਤਸਵੀਰਾਂ ਬੈਕਅਪ ਕਰਨ ਲਈ ਡੀਜੀਲੋਕਰ ਵਿੱਚ ਅਪਲੋਡ ਕਰਨੀਆਂ ਹਨ ਪਰ ਇਹ ਫੋਟੋਆਂ ਇੱਕ ਤੋਂ ਜ਼ਿਆਦਾ ਹੋਣ ਕਰਕੇ ਮੈਂ ਉਸਨੂੰ ਅਪਲੋਡ ਨਹੀਂ ਕਰ ਰਿਹਾ ਕਿਰਪਾ ਕਰਕੇ ਤੁਸੀਂ ਮੈਨੂੰ ਇਸ ਦਾ ਸੁਝਾਵ ਦਿਓ ਕਿ ਮੈਂ ਇੱਕ ਤੋਂ ਜ਼ਿਆਦਾ ਫੋਟੋ ਡੀਜੀਲੈਕਰ ਵਿੱਚ ਕਿਸ ਤਰ੍ਹਾਂ ਅਪਲੋਡ ਕਰਾਂ